ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਜਿਹੜੇ ਪ੍ਰੋਡਕਟ ਔਨਲਾਈਨ ਮੰਗਵਾਇਆ ਸੀ ਮੈਂ ਉਹਦਾ ਰੀਵਿਊ ਦੇਣਾ ਚਾਹ ਰਹੀ ਹਾਂ ਜਿਸ ਤਰ੍ਹਾਂ ਕਿ ਜਿਹੜਾ ਹੈਗਾ ਇਹ ਜਿਹੜਾ ਆਇਆ ਸੀਗਾ ਪ੍ਰੋਡਕਟ ਮੰਗਵਾਇਆ ਸੀ ਮੈਨੇ ਕੰਟੇਨਰ ਇਹਨਾਂ ਦੇ ਡਿਲੀਵਰੀ ਮੈਨ ਜਿਹੜੇ ਬਹੁਤ ਚੰਗੇ ਸੀਗੇ ਜਦਕਿ ਮੇਰਾ ਘਰ ਕਾਫ਼ੀ ਦੂਰੀ 'ਤੇ ਪੈ ਰਿਹਾ ਸੀਗਾ ਇਹਨਾਂ ਨੇ ਕੋਈ ਵੀ ਜਿਹੜਾ ਹੈਗਾ ਦੇਰੀ ਨਾ ਕਰਦੇ ਹੋਏ ਮੈਨੂੰ ਟਾਈਮ 'ਤੇ ਜਿਹੜਾ ਹੈਗਾ ਮੇਰਾ ਪਾਰਸਲ ਪਹੁੰਚਾਇਆ ਪਾਰਸਲ ਬੜੇ ਚੰਗੀ ਹਾਲਤ ਵਿੱਚ ਸੀਗਾ ਅਤੇ ਉਹਨੂੰ ਖੋਲ੍ਹਣ ਲੱਗੇ ਹੀ ਮੈਨੂੰ ਬੜੀ ਖੁਸ਼ੀ ਹੁੰਦੀ ਸੀਗੀ ਕਿ ਜਿਸ ਹਿਸਾਬ ਦੀ ਪੈਕਿੰਗ ਮੈਨੂੰ ਮਿਲ ਰਹੀ ਹੈ ਔਰ ਇੰਝ ਦਿਖ ਰਿਹਾ ਸੀਗਾ ਕਿ ਪੂਰੀ ਮਿਹਨਤ ਨਾਲ ਜਿਹੜਾ ਏ ਕੰਮ ਕੀਤਾ ਗਿਆ ਏ ਮੈਨੇ ਕੰਟੇਨਰ ਮੰਗਵਾਏ ਸੀ ਜਿਹੜੇ ਕੰਟੇਨਰ ਉਸ ਤੋਂ ਵੀ ਹੋਰ ਚੰਗੇ ਸੀਗੇ ਅਤੇ ਬੜੇ ਚੰਗੇ ਲੱਗੇ ਮੈਨੂੰ ਤੁਹਾਡਾ ਪ੍ਰੋਡਕਟ ਬੜਾ ਚੰਗਾ ਲੱਗਿਆ ਕਿਉਂਕਿ ਉਹਦੀ ਪਲਾਸਟਿਕ ਬੜੀ ਚੰਗੀ ਸੀ ਉਹਦੇ ਵਿੱਚ ਕਿਸੀ ਵੀ ਤਰ੍ਹਾਂ ਦੀ ਜਿਹੜੇ ਕਿਸੀ ਵੀ ਤਰ੍ਹਾਂ ਦੀ ਜਿਹੜੀ ਹੈਗੀ ਹੈ ਲੀਕਪਰੂਫ਼ ਸੀ ਔਰ ਹਵਾ ਨਹੀਂ ਕਰੌਸ ਹੁੰਦੀ ਉਦੇ ਉਹਦੇ ਨਾਲ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਜਿਹੜੀ ਚੀਜ਼ ਮੰਗਵਾਈ ਹੈ ਮੈਨੂੰ ਮਨੋ ਖੁਸ਼ੀ ਹੋਈ ਹੈ ਕਿ ਬੜੇ ਚੰਗੀ ਚੀਜ਼ ਮੇਰੇ ਹੱਥ ਆਈ ਹੈ ਜਿਹਦੇ ਨਾਲ ਕਿ ਮੈਨੂੰ ਇੰਝ ਹੈ ਕਿ ਮੈਂ ਅੱਗੇ ਨੂੰ ਵੀ ਇੱਦਾਂ ਬੜਾਵਾਂ ਦਊਂਗੀ ਤੁਹਾਡੇ ਪ੍ਰੋਡਕਟ ਲਈ ਕਿ ਇਹ ਬੜਾ ਚੰਗਾ ਪ੍ਰੋਡਕਟ ਲੱਗਿਆ ਧੰਨਵਾਦ ਜੀ